ਭਾਰਤੀ ਆਵਾਜਾਈ ਪ੍ਰਣਾਲੀ ਕੁਝ ਹੱਦ ਤੱਕ ਵਧੀਆ ਵੀ ਹੈ ਅਤੇ ਕੁਝ ਹੱਦ ਤੱਕ ਉਹਦੇ ਨਾਲ਼ ਪ੍ਰੋਬਲਮਸ ਵੀ ਜਿਹੜੀਆਂ ਨੇ ਬਹੁਤ ਜ਼ਿਆਦਾ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਜਿਵੇਂ ਅੱਜ ਕੱਲ੍ਹ ਤੁਸੀਂ ਵੇਖਿਆ ਕਿ ਮਤਲਬ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਉਹਦੇ 'ਤੇ ਜਿਹੜਾ ਟਰੈਫਿਕ ਰੂਲਸ ਹੈਗੇ ਨੇ ਉਹ ਇੰਨੇ ਖਾਸ ਪ੍ਰੋਪਰਲੀ ਕੋਈ ਫੋਲੋ ਨਹੀਂ ਕਰਦਾ ਹੈਗਾ ਅਤੇ ਉਹਦੇ ਨਾਲ਼ ਕੀ ਹੁੰਦਾ ਉਹਦੇ ਨਾਲ਼ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਆਉਣ ਜਾਣ ਵਿੱਚ ਹੈ ਨਾ ਅਤੇ ਉਹਦੇ ਨਾਲ਼ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ ਈਵਨ ਅਠਾਰਾਂ ਸਾਲ ਤੋਂ ਛੋਟੇ ਕਿੰਨੇ ਬੱਚੇ ਹੈਗੇ ਨੇ ਜਿਹੜੇ ਜਿਹੜੇ ਨੇ ਕਿ ਆਪਣੇ ਟ੍ਰਾਂਸਪੋਰਟ ਨੂੰ ਪ੍ਰੋਪਰਲੀ ਜਿਹੜੇ ਯੂਜ ਨਹੀਂ ਕਰਦੇ ਹੈ ਨਾ ਉਹਨਾਂ ਨੂੰ ਉਹਨਾਂ ਦੇ ਹੱਥ 'ਚ ਫੜਾ ਦਿੱਤਾ ਜਾਂਦਾ ਵੈ ਅਤੇ ਉਹ ਉਹਨਾਂ ਨੂੰ ਰੈਸ਼ ਡਰਾਈਵਿੰਗ ਕਰਦੇ ਨੇ ਜਿਹਦੇ ਨਾਲ਼ ਬੱਚੇ ਨੂੰ ਬਹੁਤ ਸਾਰੇ ਜਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਜਿਹੜੀ ਪ੍ਰਧਾਨ ਮੰਤਰੀ ਹੈਗੇ ਨੇ ਮਤਲਬ ਜਿਹੜੇ ਸੈਂਟਰ ਹੈਗੇ ਉਹਨਾਂ ਨੇ ਕਾਫ਼ੀ ਰੂਲਸ ਵਗੈਰਾ ਬਣਾਏ ਨੇ ਲੇਕਿਨ ਫੋਲੋ ਤਾਂ ਆਪਾਂ ਲੋਅ ਲੈਵਲ 'ਤੇ ਹੀ ਕਰਨਾ ਨਾ ਜਿਵੇਂ ਆਪਾਂ ਹੁਣ ਮੇਰੇ ਮਤਲਬ ਅੰਮ੍ਰਿਤਸਰ ਦੀ ਗੱਲ ਕਰ ਲਈਏ ਉੱਥੇ ਵੀ ਉਹਨਾਂ ਨੇ ਸੀ ਸੀ ਟੀ ਵੀ ਕੈਮਰੇ ਜਿਹੜੇ ਨੇ ਇੰਸਟੋਲ ਕੀਤੇ ਨੇ ਅਤੇ ਇਹ ਗੱਲ ਮੈਂ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਸੁਣਦੀ ਆ ਰਹੀ ਹਾਂ ਕਿ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਲੇਕਿਨ ਉਹ ਹਲੇ ਤੱਕ ਉਹਨਾਂ ਨੇ ਚਲਾਏ ਨਹੀਂ ਹੈਗੇ ਅਤੇ ਮੈਨੂੰ ਲੱਗਦਾ ਕਿ ਜ਼ਿਆਦਾ ਜਿਹੜਾ ਡਿਪੈਂਡ ਕਰਦਾ ਉਹ ਸਰਕਾਰ 'ਤੇ ਕਰਦਾ ਕਿ ਉਹਨਾਂ ਨੂੰ ਆਪਣੇ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਚੁਣੌਤੀਆਂ ਆ ਰਹੀਆਂ ਨੇ ਉਹਨਾਂ ਨੂੰ ਸੋਲਵ ਕਰਨ ਲਈ ਕੁਝ ਨਾ ਕੁਝ ਜਿਹੜਾ ਪ੍ਰੋਸੈਸ ਕਰਨਾ ਚਾਹੀਦਾ ਨਹੀਂ ਤਾਂ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਭਾਰਤ ਵਿੱਚ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ